ਪਸ਼ੂ ਦੇ ਗਰਭ ਦੌਰਾਨ ਅਤੇ ਜਨਮ ਦੇ ਸਮੇਂ ਦੇ ਦੌਰਾਨ ਉਹਨਾਂ ਦੀ ਸੰਭਾਲ ਬਹੁਤ ਮਹੱਤਵਪੂਰਨ ਹੁੰਦੀ ਹੈ ਤਾਂ ਕਿ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਅਤੇ ਭਲਾਈ ਸੁਰੱਖਿਤ ਰਵੇ ਇਹਨਾਂ ਦੇ ਸਮੇਂ ਦੌਰਾਨ ਧਿਆਨ ਵਿੱਚ ਰੱਖਣ ਵਾਲੀਆਂ ਕੁਝ ਮੁੱਖ ਗੱਲਾਂ ਅਤੇ ਮੁਸ਼ਕਿਲਾਂ ਦੇ ਬਾਰੇ ਵਿੱਚ ਥੋੜ੍ਹਾ ਜਿਹਾ ਵੇਰਵਾ ਦਿੱਤਾ ਗਿਆ ਹੈ ਗਰਭ ਅਵਸਥਾ ਦੌਰਾਨ ਪਸ਼ੂ ਦੀ ਖੁਰਾਕ ਬਹੁਤ ਮਹੱਤਵਪੂਰਨ ਹੁੰਦੀ ਹੈ ਮਾਂ ਨੂੰ ਉਚਿਤ ਪੋਸ਼ਣ ਦੀ ਲੋੜ ਹੁੰਦੀ ਹੈ ਜੋ ਕਿ ਸਿਹਤ ਠੀਕ ਰਵੇ ਅਤੇ ਬੱਚਾ ਸਹੀ ਤਰੀਕੇ ਨਾਲ ਵਿਕਸਿਤ ਹੋ ਸਕੇ ਪਸ਼ੂ ਦੀ ਖੁਰਾਕ ਵਿੱਚ ਪ੍ਰੋਟੀਨ ਕੈਲਸ਼ੀਅਮ ਵਿਟਾਮਿਨ ਅਤੇ ਖਣਿਜ ਤਾਂ ਸਮੇਤ ਪੂਰੀ ਖੁਰਾਕ ਸ਼ਾਮਿਲ ਹੁੰਦੀ ਏ ਗਰਭਵਤੀ ਪਸ਼ੂ ਨੂੰ ਪਾਣੀ ਦੀ ਪ੍ਰਾਪਤੀ ਦੇ ਨਾਲ ਸਹੀ ਮਾਤਰਾ ਵਿੱਚ ਖੁਰਾਕ ਮਿਲਣੀ ਚਾਹੀਦੀ ਹੈ ਇਹਨਾਂ ਨਾਲ ਪਸ਼ੂ ਨੂੰ ਐਨਰਜੀ ਮਿਲਦੀ ਹੈ ਅਤੇ ਉਹਦੀ ਤੰਦਰੁਸਤੀ ਬਣੀ ਰਹਿੰਦੀ ਹੈ ਗਰਭਵਤੀ ਪਸ਼ੂ ਲਈ ਸਾਫ ਸੁੱਕਾ ਅਤੇ ਸ਼ਾਂਤ ਵਾਤਾਵਰਣ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਸ਼ੋਰ ਤਾਪਮਾਨ ਵਿੱਚ ਤਬਦੀਲੀ ਪਸ਼ੂ ਦੀ ਸਿਹਤ ਅਤੇ ਉੱਤੇ ਬੁਰਾ ਅਸਰ ਪਾ ਸਕਦੀ ਹੈ ਸਥਾਨ ਨੂੰ ਆਰਾਮਦਾਇਕ ਬਣਾਉਣ ਲਈ ਮੌਸ਼ਨ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ ਤਾਂ ਕਿ ਕੋਈ ਇਨਫੈਕਸ਼ਨ ਨਾ ਹੋਵੇ ਗਰਭਵਤੀ ਪਸ਼ੂ ਦੀ ਸਿਹਤ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਪਸ਼ੂ ਦੇ ਬਾਡੀ ਟੈਮਪਰੇਚਰ ਖੂਨ ਦੇ ਪੈਮਾਨਾ ਤੇ ਆਮ ਰੁਝਾਵਾਂ ਦਾ ਧਿਆਨ ਰੱਖਣਾ ਮਹੱਤਵਪੂਰਨ ਹੈ ਉਹਦੇ ਖਾਣ ਪੀਣ ਜਿਵੇਂ ਕਿ ਖਾਣ ਪੀਣ ਨਾ ਕਰਨਾ ਥਕਾਵਟ ਬੁਰੀ ਖੁਸ਼ਬੂ ਦੀ ਸੂਚਨਾ ਮਿਲਣ 'ਤੇ ਪਸ਼ੂ ਦੀ ਸਿਹਤ ਵਿਸ਼ੇਸ਼ ਨੂੰ ਦਿਖਾਉਂਦੀ ਹੈ ਗਰਭਵਤੀ ਪਸ਼ੂ ਨੂੰ ਵੈਟਰਨਰੀ ਮਦਦ ਦੀ ਲੋੜ ਹੋ ਸਕਦੀ ਹੈ ਅਸੀਂ ਸਮਝ ਸਕਦੇ ਹਾਂ ਕਿ ਵੈਟਰਨਰੀ ਦਵਾਈਆਂ ਜਾਂ ਟੀਕੇ ਦੀ ਲੋੜ ਹੋ ਸਕਦੀ ਹੈ